ਹਾਂਜੀ ਅਸੀਂ ਮੋਬਾਈਲ ਡਾਟਾ ਵਰਤਦੇ ਹਾਂ ਉਹ ਇਸ ਕਰਕੇ ਵਰਤਦੇ ਹਾਂ ਕਿ ਇੱਕ ਤਾਂ ਜਦੋਂ ਬੰਦਾ ਘਰ ਇਕੱਲਾ ਹੁੰਦਾ ਹੈਗਾ ਬਾਕੀ ਸਾਰੇ ਗਏ ਵੇ ਆਪਣੇ ਕੰਮਾਂ 'ਤੇ ਅਤੇ ਉਹਦੇ ਜਿਵੇਂ ਕਿ ਬੈਂਕ ਦਾ ਕੋਈ ਆਉਂਦਾ ਕੰਮ ਉਹ ਹੋ ਜਾਂਦਾ ਔਨਲਾਈਨ ਕੋਈ ਚੀਜ਼ ਜੋ ਕਰਨੀ ਹੁੰਦੀ ਹੈ ਉਹ ਹੋ ਜਾਂਦੀ ਹੈ ਅਤੇ ਇੱਕ ਇਹ ਕਿ ਬੱਚਿਆਂ ਦੇ ਸਕੂਲ ਦੀ ਐਪ ਵਗੈਰਾ ਚੈੱਕ ਹੋ ਜਾਂਦੀ ਆ ਹੋਮਵਰਕ ਵਗੈਰਾ ਨਿਊਜ਼ ਸੁਣ ਹੋ ਜਾਂਦੀ ਹੈ ਅਤੇ ਬੱਚਿਆਂ ਦੀ ਫੀਸ ਵਗੈਰਾ ਵੀ ਔਨਲਾਈਨ ਭਰਾ ਹੋ ਜਾਂਦੀ ਹੈ ਬਿਲ ਵਗੈਰਾ ਭਰਾ ਹੋ ਜਾਂਦੇ ਹੈ ਅਸੀਂ ਦਿਨ ਵਿਚ ਡੇਢ ਜੀ ਵੀ ਦੀ ਵਰਤੋਂ ਕਰ ਲੈਦੇ ਹਾਂ ਸਮ ਸਮੱਸਿਆ ਨੈਟਵਰਕ ਦੀ ਹੈਗੀ ਐਗੀ ਆਈਡੀਆ ਦੀ ਹਾਂਜੀ ਧੰਨਵਾਦ